ਜਿਹੜੇ ਇਹ ਵਰਡ ਨੇ ਆਪਾਂ ਇਹ ਰੋਜ਼ ਦੇ ਵਿੱਚ ਰੂਟੀਨ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਬਟ ਆਪਾਂ ਨੂੰ ਯੂਜ਼ ਕਰਨ ਲੱਗੇ ਇਹ ਚੀਜ਼ ਨਹੀਂ ਪਤਾ ਲੱਗਦੀ ਕਿ ਆਪਾਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਵਰਤ ਰਹੇ ਹਾਂ ਜਾਂ ਆਪਾਂ ਇਹ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਵਰਤ ਰਹੇ ਹਾਂ ਜਿਵੇਂ ਕਿ ਹੁਣ ਆਪਾਂ ਪ੍ਰੋਫੈਸ਼ਨ ਦੇ ਵਿੱਚ ਲਗਾ ਲਉ ਮੇਰਾ ਇੰਜੀਨੀਅਰਿੰਗ ਪ੍ਰੋਫੈਸ਼ਨ ਹੈ ਇੱਥੇ ਵੀ ਕੁ ਕੁਛ ਸ਼ਬਦ ਆਪਾਂ ਜਿੱਦਾਂ ਵਰਡ ਹੀ ਲਗਾ ਲਉ ਇੱਦਾਂ ਯੂਜ਼ ਕਰਦੇ ਹਾਂ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਆਪਾਂ ਉਸ ਟਾਈਮ ਦੇ ਵਿੱਚ ਇੰਗਲਿਸ਼ ਬੋਲ ਰਹੇ ਜਾਂ ਆਪਾਂ ਪੰਜਾਬੀ ਬੋਲ ਰਹੇ ਹਾਂ ਸੋ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਇਫੈਕਟ ਹੋਈ ਹੈ